ਹੈਲੋ ਹਾਂਜੀ ਹਾਂਜੀ ਸਰ ਓਕੇ ਜੀ ਨਰਸਰੀ 'ਚ ਪਾਉਣਾ ਤਾਂ ਤੁਸੀਂ ਜੇ ਤਾਂ ਵਧੀਆ ਵਧੀਆ ਵਾਲੇ ਸਕੂਲ ਜਾਣਾ ਤਾਂ ਡੀ ਏ ਵੀ ਪਬਲਿਕ ਸਕੂਲ ਲਾਉਣਾ ਹੈਗਾ ਜੀ ਉਹ ਵਧੀਆ ਸਕੂਲ ਹੈ ਜੀ ਹਾਂਜੀ ਹੋਰ ਵੀ ਖਰਚਾ ਸਰ ਉਹ ਤਾਂ ਟੋਪ ਦਾ ਸਕੂਲ 'ਚ ਜਾਂਦਾ ਫੀਸ ਤਾਂ ਉਹਦੀ ਕਾਫ਼ੀ ਹੈ ਅਤੇ ਮਤਲਬ ਕਿ ਸਟਾਰਟਿੰਗ 'ਚ ਪਹਿਲੇ ਐਡਮੀਸ਼ਨ ਫੀਸ ਦੇਣੀ ਪੈਂਦੀ ਹੈ ਪੰਜਾਹ ਕੁ ਹਜ਼ਾਰ ਸੱਠ ਹਜ਼ਾਰ ਹੁੰਦੀ ਹੈ ਉਸ ਤੋਂ ਬਾਅਦ 'ਚ ਫਿਰ ਮੰਥਲੀ ਫੀਸ ਪੰਜ ਛੇ ਹਜ਼ਾਰ ਪਰ ਪਰ ਮੰਨਥ ਹੈਗੀ ਹੈ ਹਾਂਜੀ ਤੁਸੀਂ ਵੈਸੇ ਕਿੰਨਾ ਕੁ ਕਿੰਨਾ ਕ ਖਰਚਾ ਛੇ ਹਜ਼ਾਰ ਚੋਂ ਕਿੰਨਾ ਘਟਾਉਣਾ ਚਾਹੁੰਦੇ ਹੋ ਆਪਣੇ ਖਰਚੇ ਨੂੰ ਹਾਂਜੀ ਮੈਂ ਕਿਹਾ ਕ ਚਾਰ ਹਜ਼ਾਰ ਫਿਰ ਤੁਸੀਂ ਰਾਮ ਆਸ਼ਰਮ ਸਕੂਲ ਲੈ ਜਾਓ ਉਹ ਵੀ ਵਧੀਆ ਸੀ ਬੀ ਐੱਸ ਈ ਬੋਰਡ ਹੀ ਹੈ ਤੇ ਉੱਥੇ ਵੀ ਪੜ੍ਹਾਈ ਅੱਛੀ ਹੈ ਹਿੰਦੀ ਮੀਡੀਅਮ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਵੀ ਹੈਗਾ ਵਾ ਉਹ ਪਰ ਉਹ ਵੀ ਕਾਫ਼ੀ ਐਕਸਪੈਂਸਿਵ ਹੈ ਕਾਫ਼ੀ ਮਹਿੰਗੇ ਪੈ ਜਾਣਾ ਵਾ ਉਸ ਤੋਂ ਇਲਾਵਾ ਤੁਸੀਂ ਪੁਲਿਸ ਡੀ ਏ ਵੀ ਸਕੂਲ ਜਾ ਸਕਦੇ ਹੋ ਉਹ ਵੀ ਠੀਕ ਉਹ ਉਹਦਾ ਖਰਚਾ ਘੱਟ ਹੈ ਹਾਂਜੀ ਹਾਂਜੀ ਹੈ ਹਾਂਜੀ ਹਾਂਜੀ ਇਹ ਰਿਆਨ ਇੱਕ ਰਿਆਨ ਸਕੂਲ ਤੁਹਾਡਾ ਘਰ ਕਿੱਥੇ ਕਰਕੇ ਹੈਗਾ ਵੈਸੇ ਨਿਊ ਮੋਰਛਾ ਰਹਿੰਦੇ ਅਤੇ ਇੱਥੇ ਏ ਰਿਆਨ ਇੰਟਲਨੈਸ਼ਨਲ ਸਕੂਲ ਤੁਹਾਡੇ ਲਾਗੇ ਹੈ ਉਹ ਜ਼ਿਆਦਾ ਬੈਟਰ ਰਹੇਗਾ ਨਾਲੇ ਫੀਸ ਵੀ ਠੀਕ ਹੈ ਨਾਲੇ ਪਿੱਕ ਐਂਡ ਡਰੋਪ ਫਸਿਲਟੀ ਠੀਕ ਹੈਗੀ ਉੱਥੋਂ ਵੈਨ ਪੰਦਰ੍ਹਾਂ ਵੀਹ ਮਿੰਟ 'ਚ ਬੱਚਾ ਘਰ ਆ ਜਾਂਦਾ ਪੰਦਰ੍ਹਾਂ ਵੀਹ ਮਿੰਟ 'ਚ ਘਰ ਬੱਚਾ ਪਹੁੰਚ ਜਾਏਗਾ ਹਾਂ ਠੀਕ ਆ ਸਰ ਤੁਸੀਂ ਆਰਾਮ ਨਾਲ਼ ਤੁਸੀਂ ਸੋ ਸਾਡਾ ਸਕੂਲ ਵੀ ਲਾਗੇ ਹੀ ਪੈਂਦਾ ਵੈਸੇ ਨਿਊ ਮੋਰਛਾ ਦੇ ਅਤੇ ਉੱਥੇ ਜਾ ਕੇ ਚਲੋ ਠੀਕ ਆ ਸਰ ਤੁਸੀਂ ਜਦੋਂ ਪਲੈਨ ਕਰੋਗੇ ਮੈਨੂੰ ਦੱਸ ਦੇਣਾ ਠੀਕ ਹੈ ਸਰ ਓਕੇ ਜੀ ਓਕੇ ਜੀ